ਹਾਂਜੀ ਜਿਹੜਾ ਨਾ ਮੈਂ ਯੋਗਾ ਦਾ ਅਭਿਆਸ ਨਾ ਆਮ ਤੌਰ 'ਤੇ ਮੈਂ ਛੱਤ ਦੇ ਉੱਪਰ ਕਰ ਦਾਂਗਾ ਅਸੀਂ ਨਾ ਸਾਡਾ ਖੇਤ ਦੇ ਵਿੱਚ ਘਰ ਹੈਗਾ ਅਤੇ ਆਸੇ ਪਾਸੇ ਕੋਈ ਸ਼ੋਰ ਸ਼ਰਾਬਾ ਵੀ ਨਹੀਂ ਬਸ ਦਰੱਖਤ ਨੇਗੇ ਉੱਥੇ ਜਾਂ ਉੱਥੇ ਚਿੜੀਆਂ ਦੀਆਂ ਮਿੱਠੀਆਂ ਮਿੱਠੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਨੇ ਸਵੇਰੇ ਉੱਠ ਕੇ ਨਾ ਮਨ ਨਾ ਇੰਨਾ ਉੱਥੇ ਵਧੀਆ ਜੀਅ ਲੱਗਦਾ ਉੱਪਰਲੀ ਛੱਤ ਦੇ ਉੱਪਰ ਮੈਂ ਚਲਾ ਜਾਂਦਾ ਡਬਲ ਸਟੋਰੀ ਮਕਾਨ ਆ ਆਪਣਾ ਅਤੇ ਆਸੇ ਪਾਸੇ ਦਰੱਖਤਾਂ ਦਾ ਝੁੰਡ ਹੈਗਾ ਉੱਥੇ ਕੀ ਹੈ ਛੱਤ ਸਾਡੀ ਬਿਲਕੁਲ ਸਾਫ਼ ਆ ਉੱਥੇ ਮੇਰਾ ਇੱਕ ਯੋਗਾ ਮੈਟ ਰੱਖਿਆ ਹੋਇਆ ਯੋਗਾ ਮੈਟ ਮੈਂ ਵਿਛਾ ਕੇ ਆਪਣਾ ਹਲਕੇ ਹਲਕੇ ਆਪਦੇ ਯੋਗਾ ਆਸਣ ਕਰਦਾ ਹੈਗਾ ਅਤੇ ਨਾਲ ਨਾਲ ਕੀ ਆ ਉੱਥੇ ਨਾ ਇੰਨੀ ਠੰਡੀ ਹਵਾ ਆਉਂਦੀ ਹੈ ਬਹੁਤ ਜ਼ਿਆਦਾ ਉੱਥੇ ਮਨ ਨੂੰ ਸ਼ਾਂਤੀ ਇੰਨੀ ਮਿਲਦੀ ਹੈ ਨਾ ਨਾ ਤਾਂ ਕੋਈ ਉੱਥੇ ਸ਼ੋਰ ਸ਼ਰਾਬ ਹੈਗਾ ਭਾਈ ਬਸ ਇਕੱਲੀ ਚਿੜੀਆਂ ਦੀ ਅਤੇ ਕੁਦਰਤੀ ਵਾਤਾਵਰਨ ਆ ਅਤੇ ਉਹਦੇ ਵਿੱਚ ਕੀ ਆ ਧਿਆਨ ਇੰਨਾ ਜ਼ਿਆਦਾ ਫੋਕਸ ਹੁੰਦਾ ਹੈਗਾ ਅਤੇ ਐਂ ਬਹੁਤ ਵਧੀਆ ਲੱਗਦਾ ਹੈਗਾ ਕਿ ਨਾ ਵੀ ਜਾਣੀ ਕਿ ਨਜ਼ਾਰਾ ਆ ਜਾਂਦਾ ਸਰ ਇੰਨਾ ਫੁੱਲ ਵਰਗਾ ਹੌਲਾ ਹੋ ਜਾਂਦਾ ਯੋਗਾ ਕਰਕੇ ਅਤੇ ਮੈਂ ਇਹ ਸਾਰਿਆਂ ਨੂੰ ਇਹ ਹੀ ਸਲਾਹ ਦੇਊਂਗਾ ਵੀ ਤੁਸੀਂ ਸਾਰਿਆਂ ਨੇ ਛੱਤ ਦੇ ਉੱਪਰ ਹੀ ਯੋਗਾ ਕਰਿਆ ਕਰੋ ਖੁੱਲ੍ਹੇ ਦਰੱਖਤਾਂ ਦੇ ਨੀਚੇ ਧੰਨਵਾਦ ਜੀ